ਮੈ ਆਪਣਾ ਪੋਜੀਟਿਵ ਰਿਵਿਊ ਡਸਬਿਨ 'ਤੇ ਦੇਣਾ ਚਾਹੁੰਦੀ ਹਾਂ ਮੈਂ ਕੁਝ ਦਿਨ ਪਹਿਲਾਂ ਇੱਕ ਵੈਬਸਾਈਟ ਉੱਤੇ ਇੱਕ ਡਸਟਬਿਨ ਦੇਖਿਆ ਸੀ ਮੈਨੂੰ ਉਹ ਕਾਫੀ ਪਸੰਦ ਆਇਆ ਫਿਰ ਮੈਂ ਉਹਦੀ ਪੂਰੀ ਜਾਣਕਾਰੀ ਲਈ ਵੈਬਸਾਈਟ ਤੋਂ ਮੈਂ ਉਸ ਦੇ ਰਿਵਿਊਜ ਵੀ ਦੇਖੇ ਉਸ ਦੇ ਰਿਵਿਊਜ ਵੀ ਕਾਫੀ ਅੱਛੇ ਆਏ ਸੀ ਉਸ 'ਤੇ ਸਾਰੇ ਜਿਹੜੇ ਕਸਟਮਰ ਜਿਹਨਾਂ ਨੇ ਲਏ ਸੀ ਉਹਨਾਂ ਨੇ ਰਿਵਿਊ ਕਾਫੀ ਅੱਛੇ ਦਿੱਤੇ ਸੀ ਅਤੇ ਉਹਦੀ ਰੇਟਿੰਗ ਵੀ ਬਹੁਤ ਸਹੀ ਸੀ ਤਾਂ ਜੋ ਮੈਨੂੰ ਪਸੰਦ ਆਇਆ ਸਾਰਿਆਂ ਨੇ ਕਾਫੀ ਪਸੰਦ ਕੀਤਾ ਸੀ ਫਿਰ ਮੈਂ ਉੱਥੋਂ ਆਰਡਰ ਕਰ ਲਿਆ ਨਾਲ ਮੈਨੂੰ ਜਦੋਂ ਮੈਂ ਆਰਡਰ ਕੀਤਾ ਮੈਨੂੰ ਉਸ ਦੇ ਨਾਲ ਇੱਕ ਬਾਏ ਵੰਨ ਅਤੇ ਗੈਟ ਵੰਨ ਦਾ ਆਫਰ ਵੀ ਮਿਲਿਆ ਮੈਨੂੰ ਡਸਟਬਿਨ ਦੇ ਨਾਲ ਇੱਕ ਝਾੜੂ ਗਿਫਟ ਵਿੱਚ ਮਿਲਿਆ ਅਤੇ ਜਦੋਂ ਪਾਰਸਲ ਘਰ ਆਇਆ ਤਾਂ ਉਸ ਦੀ ਜਦੋਂ ਮੈਂ ਉਸ ਨੂੰ ਵੇਖਿਆ ਤਾਂ ਉਸ ਦਾ ਰੰਗ ਵੀ ਬਹੁਤ ਵਧੀਆ ਸੀ ਜਿੱਦਾਂ ਦਿਖਾਇਆ ਤੇ ਉਸ ਦਾ ਨਾਲ ਦਾ ਹੀ ਆਇਆ ਅਤੇ ਉਸ ਦੀ ਕੁਆਲਿਟੀ ਵੀ ਕਾਫੀ ਵਧੀਆ ਸੀ ਮਟੀਰੀਅਲ ਦੀ ਅਤੇ ਉਸ ਦਾ ਸਾਈਜ਼ ਵੀ ਕਾਫੀ ਵੱਡਾ ਹੈ ਉਸ ਦਾ ਵੀ ਕਾਫੀ ਚੀਜ਼ਾਂ ਵਿੱਚ ਯੂਜ਼ ਵੀ ਕਰ ਸਕਦੇ ਹਾਂ ਤਾਂ ਅਸੀਂ ਅਗਰ ਕੂੜੇ ਲਈ ਡਸਟਬਿਨ ਯੂਜ਼ ਕਰ ਰਹੇ ਹਾਂ ਤਾਂ ਉਸ ਤੋਂ ਇਲਾਵਾ ਅਸੀਂ ਉਹਦੇ ਵਿੱਚ ਕੁਝ ਕੈਰੀ ਵੀ ਕਰ ਸਕਦੇ ਹਾਂ ਜਿੱਦਾਂ ਅਸੀਂ ਕੁਝ ਸਮਾਨ ਰੱਖਣਾ ਹੋਏ ਤਾਂ ਉਹ ਵੀ ਕਰ ਸਕਦੇ ਹਾਂ ਕਿਉਂਕਿ ਉਹ ਸਾਈਜ਼ ਵਿੱਚ ਕਾਫੀ ਵੱਡਾ ਹੈ ਤੁਸੀਂ ਉਸ ਨੂੰ ਕਿਸੇ ਵੀ ਚੀਜ਼ ਵਿੱਚ ਯੂਜ਼ ਕਰ ਸਕਦੇ ਹੋ ਤਾਂ ਮੇਰਾ ਐਕਸਪੀਰੀਅੰਸ ਡਸਟਬਿਨ ਨਾਲ ਬਹੁਤ ਵਧੀਆ ਰਿਹਾ ਮੈਨੂੰ ਵੈਬਸਾਈਟ ਕਾਫੀ ਪਸੰਦ ਆਈ ਉਸ 'ਤੇ ਉੱਤੇ ਕਾਫੀ ਸਹੀ ਤਰੀਕੇ ਨਾਲ ਆਪਣੀ ਪ੍ਰੋਡਕਟ ਵੇਚੇ ਜਾਂਦੇ ਹਨ ਮੈਂ ਡਸਟਬਿਨ ਦਾ ਰੀਵਿਊ ਬਹੁਤ ਅੱਛਾ ਸੀ